ਮੇਰੀ ਨਜ਼ਰ ਵਿੱਚ ਇੱਕ ਕਾਰੋਬਾਰੀ ਹਨ ਜਿਹਨਾਂ ਦਾ ਕਾਰੋਬਾਰ ਕਾਫੀ ਵੱਡਾ ਸੀ ਅਤੇ ਉਹਨਾਂ ਦਾ ਕਾਰੋਬਾਰ ਅੱਜ ਦੇ ਸਮੇਂ ਵਿੱਚ ਡੁੱਬ ਚੁੱਕਿਆ ਹੈ ਮੈਂ ਗੱਲ ਕਰ ਰਹੀ ਹਾਂ ਆਪਣੇ ਪਿਤਾ ਜੀ ਦੇ ਦੋਸਤ ਦੀ ਉਹਨਾਂ ਦਾ ਕਾਰੋਬਾਰ ਕੱਪੜਿਆਂ ਦਾ ਸੀ ਉਹਨਾਂ ਦੀਆਂ ਖੁਦ ਦੀਆਂ ਕਾਫੀ ਫੈਕਟਰੀਆਂ ਸੀ ਜਿਹਨਾਂ ਵਿੱਚ ਕੱਪੜਾ ਆਂਦਾ ਜਾਂਦਾ ਸੀ ਅਤੇ ਖੁਦ ਹੀ ਬਣਾਇਆ ਜਾਂਦਾ ਸੀ ਉਹਨਾਂ ਦੀ ਇੱਕ ਗਲਤੀ ਕਰਕੇ ਉਹਨਾਂ ਦਾ ਸਾਰਾ ਕਾਰੋਬਾਰ ਡੁੱਬ ਚੁੱਕਿਆ ਹੈ ਅਤੇ ਅੱਜ ਦੇ ਸਮੇਂ ਵਿੱਚ ਉਹ ਉਹਨਾਂ ਕੋਲ ਕੁਝ ਵੀ ਨਹੀਂ ਰਿਹਾ ਉਹਨਾਂ ਦੀ ਜੂਆ ਖੇਡਣ ਦੀ ਇੰਨੀ ਗੰਦੀ ਆਦਤ ਕਰਕੇ ਉਹਨਾਂ ਦਾ ਅੱਜ ਦਾ ਸਾਰਾ ਅੱਜ ਦਾ ਸਾਰਾ ਘਰ ਖਰਾਬ ਹੋ ਚੁੱਕਿਆ ਹੈ ਅਤੇ ਉਹਨਾਂ ਦੇ ਬੱਚੇ ਵੀ ਰੁਲ ਚੁੱਕੇ ਨੇ ਉਹਨਾਂ ਦਾ ਫਿਊਚਰ ਵੀ ਖਰਾਬ ਹੋ ਚੁੱਕਿਆ ਹੈ ਅਤੇ ਉਹਨਾਂ ਦੀ ਇੱਕ ਗੰਦੀ ਜੂਆ ਖੇਡਣ ਦੀ ਲੱਤ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਵੀ ਖਰਾਬ ਕਰ ਲਿਆ ਹੈ ਅਤੇ ਹੌਲੀ ਹੌਲੀ ਉਹਨਾਂ ਨੇ ਜੂਆ ਖੇਡਣ ਕਰਕੇ ਹੀ ਆਪਣੇ ਘਰ ਦਾ ਸਮਾਨ ਵੇਚ ਚੁਕੇ ਅਤੇ ਉਹਨਾਂ ਦੇ ਕਰਕੇ ਹੀ ਉਹਨਾਂ ਦੀ ਫੈਕਟਰੀਆਂ ਵੀ ਖਤਮ ਹੋ ਗਈਆਂ ਅਤੇ ਬੰਦ ਹੋ ਗਈਆਂ